ਹੈਲੋ ਹਾਂਜੀ ਸੰਦੀਪ ਜੀ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਹੈਲੋ ਮੈਂ ਮਾਨਸਾ ਏਰੀਏ ਤੋਂ ਬੋਲ ਰਿਹਾ ਸਰ ਅਤੇ ਮੈਂ ਜੋ ਬਠਿੰਡੇ ਸੈਂਟਰ ਯੂਨੀਵਰਸਿਟੀ ਆਪਣੀ ਹੈਗੀ ਹੈ ਇਹਦੇ ਬਾਰੇ ਇਸ ਤੋਂ ਉੱਥੋਂ ਨੌਲੇਜ ਲੈਣੀ ਸੀਗੀ ਅਤੇ ਉਹਦੇ ਬਾਰੇ ਪੁੱਛਣਾ ਸੀਗਾ ਵੀ ਉਹ ਕਦੋਂ ਤੋਂ ਕਹਿਣ ਦਾ ਮਤਲਬ ਆਪਣੇ ਤਿਆਰ ਹੋਈ ਉਹਦੀ ਕੀ ਪਲੈਨਿੰਗ ਸੀਗੀ ਸਾਰੀ ਅਤੇ ਹੈ ਨਾ ਜੋ ਜਿਵੇਂ ਮੈਂ ਹਾਂ ਜੀ ਜੀ ਜੀ ਜੀ ਜੀ ਜੀ ਹਾਂਜੀ ਜੀ ਜੀ ਜੀ ਹਾਂਜੀ ਹਾਂਜੀ ਹਾਂਜੀ ਜੀ

ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਜੀ

ਜੀ ਜੀ ਜੀ ਜੀ ਜੀ

ਜੀ ਜੀ ਜੀ ਜੀ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਜੀ ਅਤੇ ਹੋਸਟਲ ਦੇ ਵਿੱਚ ਕਿੰਨੇ ਕੁ ਰੂਮ ਹੋ ਸਕਦੇ ਆ ਬੱਚਿਆਂ ਲਈ ਅੱਛਾ ਜੀ ਜੀ ਜੀ ਜੀ ਅੱਛਾ ਅੱਛਾ ਦਾ ਅਲੱਗ ਅਲੱਗ